ਮੇਰਾ ਨਾਮ ਖੁਸ਼ਦੀਪ ਬਾਦਲ ਮੈਂ ਪਿੰਡ ਡੱਬਵਾਲੀ ਦੀ ਰਹਿਣ ਵਾਲੀ ਹਾਂ ਮੈਂ ਕੱਲ੍ਹ ਅਸੀਂ ਦਰਅਸਲ ਘੁੰਮਣ ਜਾਣ ਵਾਲੇ ਸੀਗੇ ਤਾਂ ਪਰ ਅਚਾਨਕ ਹੀ ਮੌਸਮ ਬਹੁਤ ਜ਼ਿਆਦਾ ਖ਼ਰਾਬ ਹੋ ਗਿਆ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਅਤੇ ਬਹੁਤ ਤੇਜ਼ ਬਾਰਿਸ਼ ਵੀ ਹੋਣ ਲੱਗ ਗਈ ਜਿਹਦੇ ਕਾਰਨ ਸਾਡੇ ਤੋਂ ਜਾਇਆ ਨਹੀਂ ਗਿਆ ਅਤੇ ਉਹ ਬੁਕ ਅਤੇ ਅਸੀਂ ਟਿਕਟਾਂ ਬੁਕ ਕੀਤੀਆਂ ਸਾਡੀਆਂ ਵਿਅਰਥ ਗਈਆਂ ਤਾਂ ਕਰਕੇ ਤੁਹਾਨੂੰ ਬੇਨਤੀ ਹੈ ਕਿ ਸਾਡੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਸਾਡੇ ਪੈਸੇ ਰਿਫੰਡ ਹੋ ਜਾਣ